ਮੇਰੇ ਰਾਜ ਦੇ ਵਿੱਚ ਮੀਡੀਆ ਨੇ ਬਹੁਤ ਹੀ ਜ਼ਿਆਦਾ ਆਪਣੀ ਭੂਮਿਕਾ ਨਿਭਾਈ ਆ ਉਹ ਹਰ ਵੇਲੇ ਕੁਝ ਨਾ ਕੁਝ ਖਬਰਾਂ ਦਿੰਦੀਆਂ ਰਹਿੰਦੀਆਂ ਵਾ ਕਿ ਅੱਜ ਇਹ ਹੋ ਗਿਆ ਇਸ ਥਾਂ 'ਤੇ ਇਹ ਦੁਰਘਟਨਾ ਹੋ ਗਈ ਇਸ ਥਾਂ 'ਤੇ ਇਸ ਇਸ ਬੰਦੇ ਦਾ ਮਰਡਰ ਹੋ ਗਿਆ ਜੋ ਵੀ ਹੋਇਆ ਉਹਨਾਂ ਚੀਜ਼ਾਂ ਬਾਰੇ ਦੱਸਦਾ ਇਹਦੇ ਨਾਲ ਸਾਨੂੰ ਸਾਡੀ ਨੌਲੇਜ ਸਾਡਾ ਵਿਕਾਸ ਹੋਰ ਜ਼ਿਆਦਾ ਹੁੰਦਾ ਅਤੇ ਨਵੀਂ ਦੇ ਵਿੱਚ ਸੋਸ਼ਲ ਮੀਡੀਆ ਨੇ ਵੀ ਆਪਣਾ ਜਿਹੜਾ ਸਥਾਨ ਹੈ ਉਹ ਕੰਮ ਕਾਇਆ ਕਾਇਮ ਕੀਤਾ ਹੈ ਅਤੇ ਉਹਨਾਂ ਦੇ ਵਿੱਚ ਜਿਹੜਾ ਹੈਗਾ ਭਾਈਚਾਰੇ ਨੂੰ ਹੋਰ ਵਾਧਾ ਦਿੱਤਾ ਹੈ ਕਿਉਂਕਿ ਜਦੋਂ ਦਾ ਇੰਟਰਨੈਟ ਆਇਆ ਹੈ ਉਸ ਤੋਂ ਬਾਅਦ ਰਿਸ਼ਤੇ ਬਹੁਤ ਵਧੇ ਨੇ ਅਸੀਂ ਕਿਸੇ ਨਾਲ ਵੀ ਕਿਸੇ ਵੀ ਟਾਈਮ ਕਦੋਂ ਵੀ ਜਦੋਂ ਸਾਡਾ ਜੀਅ ਹੋਵੇ ਅਸੀਂ ਉਦੋਂ ਗੱਲ ਕਰ ਸਕਦੇ ਉਹਨਾਂ ਨਾਲ ਜਿੱਥੋਂ ਸਾਡਾ ਮਨ ਹੋਵੇ ਕਿਸੇ ਵੀ ਸਮੇਂ ਅਸੀਂ ਗੱਲ ਕਰ ਸਕਦੇ ਹਾਂ ਸਾਨੂੰ ਇਸ ਵਾਰ ਇਹ ਸੋਚਣਾ ਨਹੀਂ ਪੈਂਦਾ ਕਿ ਸਾਨੂੰ ਉਹਨੂੰ ਚਿੱਠੀ ਲਿਖਣੀ ਪੈਣੀ ਆ ਜਾਂ ਇਹ ਜਿਹੜੀ ਗੱਲ ਹੈ ਉਹਦੇ ਕੋਲ ਹੋਰ ਕਈ ਦਿਨਾਂ ਬਾਅਦ ਪਹੁੰਚੇਗੀ ਇਹ ਸਭ ਚੀਜ਼ਾਂ ਹੁਣ ਨਹੀਂ ਰਹੀਆਂ ਹੁਣ ਇਹ ਬਹੁਤ ਡਿਵੈਲਪ ਹੋ ਗਿਆ ਅਤੇ ਅਰਥ ਵਿਵਸਥਾ 'ਤੇ ਵੀ ਇਹਨਾਂ ਨੇ ਬਹੁਤ ਸਾਨੂੰ ਸਹਾਈ ਕੀਤਾ ਭਾਰਤ ਦੀ ਅਰਥ ਵਿਵਸਥਾ 'ਤੇ ਵੀ ਇਹਨਾਂ ਨੇ ਬਹੁਤ ਧਿਆਨ ਦਿੱਤਾ ਅਤੇ ਜੇ ਅਸੀਂ ਮੀਡੀਆ ਦੀ ਗੱਲ ਕਰੀਏ ਤਾਂ ਸਾਨੂੰ ਉਹਦੇ ਤਰੱਕੀ ਨੌਕਰੀ ਕਿਵੇਂ ਸਾਨੂੰ ਪ੍ਰਾਪਤ ਹੋਈ ਏ ਇਹਨਾਂ ਦੇ ਬਹੁਤ ਵਿਕਲਪ ਹਨ ਅੱਜ ਕੱਲ੍ਹ ਮੀਡੀਆ ਦੇ ਨਾਲ ਅੱਡ ਅੱਡ ਕੋਰਸ ਵੀ ਹੁੰਦੇ ਆ ਜਿਸ ਨਾਲ ਅਸੀਂ ਪੱਤਰਕਾਰ ਬਣ ਸਕਦੇ ਹਾਂ ਅਸੀਂ ਕੁਝ ਫੌਜ ਅਸੀਂ ਫੋਟੋਗ੍ਰਾਫੀ ਵੀ ਕਰ ਸਕਦੇ ਹਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਸਾਨੂੰ ਕੰਪਿਊਟਰ 'ਤੇ ਕੰਮ ਕਰਨਾ ਆਉਣਾ ਚਾਹੀਦਾ ਮੀਡੀਆ ਦੇ ਵਿੱਚ ਨਿਊਜ਼ ਮੀਡੀਆ ਦੇ ਸਾਡੇ ਕੋਲ ਬਹੁਤ ਵਿਕਲਪ ਨੇ ਅਸੀਂ ਨੌਕਰੀ ਕਰ ਹੀ ਸਕਦੇ ਹਾਂ ਸਾਨੂੰ ਇੱਦਾਂ ਨਹੀਂ ਜੀ ਅਸੀਂ ਆਹ ਨਹੀਂ ਕਰਨਾ ਅਤੇ ਉਹ ਨਹੀਂ ਕਰਨਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਸਾਰੇ ਢੰਗ ਨਾਲ ਅਸੀਂ ਕੰਮ ਕਰ ਸਕਦੇ ਹਾਂ ਸਾਡੇ ਕੋਲ ਬਹੁਤ ਆਪਸ਼ਨ ਆ ਕੰਮ ਕਰਨ ਦੇ ਅਸੀਂ ਕਿਸੇ ਵੀ ਸਮੇਂ ਸਾਨੂੰ ਅਸੀਂ ਕਿਸੇ ਦੇ ਹੇਠ ਰਹਿ ਕੇ ਅਸੀਂ ਉਹਨਾਂ ਤੋਂ ਉਹ ਚੀਜ਼ ਸਿੱਖ ਸਕਦੇ ਹਾਂ ਕਿ ਉਹ ਬੰਦਾ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ ਕਿਸ ਤਰੀਕੇ ਨਾਲ ਉਹ ਬੋਲ ਰਿਹਾ ਹੈ ਕਿਸ ਤਰੀਕੇ ਨਾਲ ਉਸ ਨੇ ਇਹ ਜਿਹੜੀ ਖਬਰ ਆ ਉਹ ਦੂਸਰੇ ਬੰਦੇ ਤੱਕ ਪਹੁੰਚਾਈ ਹੈ ਇਹ ਸਭ ਕੁਝ ਸਾਨੂੰ ਕਰਨਾ ਆਉਣਾ ਚਾਹੀਦਾ